ਹੈਲੋ ਸਤਿ ਸ਼੍ਰੀ ਅਕਾਲ ਸਰ ਕੀ ਤੁਸੀਂ ਕਪੂਰ ਟਰੈਵਲ ਏਜੰਸੀ ਤੋਂ ਗੱਲ ਕਰ ਰਹੇ ਹੋ ਐਕਚੁਲੀ ਸਰ ਮੈਂ ਪਤਾ ਕਰਨਾ ਸੀ ਮੈਂ ਅਤੇ ਮੇਰੇ ਚਾਰ ਪੰਜ ਹੋਰ ਦੋਸਤਾਂ ਨੇ ਹਿਮਾਚਲ ਦੇ ਕੁੱਲੂ ਮਨਾਲੀ ਘੁੰਮਣ ਜਾਣ ਦਾ ਫੈਸਲਾ ਕੀਤਾ ਹੈ ਅਤੇ ਮੈਂ ਪਤਾ ਕਰਨਾ ਚਾਹੁੰਦਾ ਸੀ ਕਿ ਕੀ ਕੀ ਹਿਸਾਬ ਆ ਛੋਟੀ ਗੱਡੀ ਅਤੇ ਵੱਡੀ ਗੱਡੀ ਦਾ ਅਸੀਂ ਵੈਸੇ ਸਵਿਫਟ ਕਾਰ ਲੈ ਕੇ ਜਾਣਾ ਚਾਹੁੰਦੇ ਓਂ ਕੀ ਤੁਸੀਂ ਸਾਨੂੰ ਦੱਸ ਸਕਦੇ ਆ ਕਿ ਚਾਰ ਪੰਜ ਦਿਨ ਦੇ ਲਈ ਅਗਰ ਆਪਾਂ ਗੱਡੀ ਲੈ ਕੇ ਜਾਂਦੇ ਹਾਂ ਤਾਂ ਕਿੰਨਾ ਖਰਚਾ ਬਣਦਾ ਹੈ ਜਾਂ ਫਿਰ ਅਕ ਅਗਰ ਅਸੀਂ ਦੋ ਤਿੰਨ ਦੋਸਤ ਹੋਰ ਰਲ ਜਾਂਦੇ ਹਾਂ ਅਤੇ ਵੱਡੀ ਗੱਡੀ ਲੈਣਾ ਚਾਹਵਾਂਗੇ ਇਨੋਵਾ ਤਾਂ ਉਹਦੇ ਕਿੰਨੇ ਖਰਚਾ ਪਵੇਗਾ ਸਾਨੂੰ ਤੁਹਾਨੂੰ ਇਹ ਜਾਣਕਾਰੀ ਦੇਣ ਦੇ ਲਈ ਸਾਡਾ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸਲਾਹ ਬਣਾ ਕੇ ਤੁਹਾਨੂੰ ਦੁਬਾਰਾ ਫ਼ੋਨ ਕਰਾਂਗੇ